ਹਾਂਜੀ ਸਿੱਖਿਆ ਪ੍ਰਣਾਲੀ 'ਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਕਾਫੀ ਤਰ੍ਹਾਂ ਦਾ ਮਤਲਬ ਹੈਗਾ ਵਿਸ਼ੇਸ਼ ਬੱਚੇ ਜਿਵੇਂ ਕੋਈ ਅੰਨੇ ਬੋਲੇ ਜਾਂ ਅਪਾਹਜ ਬੱਚੇ ਹੁੰਦੇ ਆ ਉਹਨਾਂ ਲਈ ਸਪੈਸ਼ਲ ਸਕੂਲ ਵੀ ਹੁੰਦੇ ਆ ਅਤੇ ਉਹਨਾਂ ਦੇ ਟ੍ਰੇਨਰ ਵੀ ਅਲੱਗ ਤਰ੍ਹਾਂ ਦੇ ਹੁੰਦੇ ਆ ਆਮ ਟੀਚਰਾਂ ਵਾਂਗੂੰ ਨਹੀਂ ਹੁੰਦੇ ਜਿਵੇਂ ਉਹਨਾਂ ਨੂੰ ਸਾਈਨ ਲੈਂਗੁਏਜ ਵਗੈਰਾ ਆਉਂਦੀ ਹੁੰਦੀ ਆ ਉਹਦੇ ਨਾਲ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਸਕਦੇ ਹੈਗੇ ਜੋ ਨੋਰਮਲ ਟੀਚਰ ਨਹੀਂ ਪੜ੍ਹਾ ਸਕਦਾ ਉਹਨਾਂ ਨੂੰ ਇਸ ਲਈ ਉਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਬਠਿੰਡੇ 'ਚ ਮਹੰਤ ਗੁਰਵੰਦਾ ਗੁਰਵੰਤਾ ਦਾਸ ਸਕੂਲ ਹੈਗਾ ਉਹ ਮਤਲਬ ਹੋਸਟਲ ਵੀ ਆ ਉਹਦੇ ਵਿੱਚ ਹੀ ਬੱਚੇ ਉੱਥੇ ਹੀ ਰਹਿੰਦੇ ਹੈਗੇ ਅਤੇ ਉਸ ਉਹ 'ਚ ਟੀਚਰ ਵੀ ਉਸ ਤਰ੍ਹਾਂ ਦੇ ਹੀ ਰੱਖੇ ਜਾਂਦੇ ਆ ਜਿਹੜੇ ਅੰਨੇ ਬੋਲੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੈਗੇ ਅਤੇ ਜਿਹੜੇ ਵਿਸ਼ੇਸ਼ ਇਸ ਤਰ੍ਹਾਂ ਕੋਈ ਜਿਹਦੇ 'ਚ ਹੁੰਦੀ ਹੈ ਬੱਚਿਆਂ 'ਚ ਅਪਾਹਜਤਾ ਤਾਂ ਉਹਨਾਂ 'ਚ ਕਈ ਵਿਸ਼ੇਸ਼ ਗੁਣ ਵੀ ਹੁੰਦੇ ਆ